ਪਿਛਲੇ ਕੁਝ ਸਾਲਾਂ ਤੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਬਹੁਤ ਹੀ ਤਬਦੀਲੀ ਪਾਈ ਗਈ ਖ਼ਾਸ ਕਰਕੇ ਇਸਦੇ ਆਰਥਿਕਤਾ ਅਤੇ ਬੁਨਿਆਦੀ ਢਾਂਚੇ ਵਿੱਚ ਬਹੁਤ ਹੀ ਤਬਦੀਲੀ ਪਾਈ ਗਈ ਇੱਥੋਂ ਦੇ ਲੋਕਾਂ ਨੇ ਬਹੁਤ ਹੀ ਸਾਥ ਦਿੱਤਾ ਇਸ ਤਬਦੀਲੀ ਨੂੰ ਬਣਾਉਣ ਲਈ ਇੱਥੇ ਬਹੁਤ ਸਾਰੇ ਵੱਡੇ ਪਾਰਕ ਮਿਊਜ਼ੀਅਮ ਅਤੇ ਧਾਰਮਿਕ ਸਥਾਨਕ ਹਨ ਜਿਹੜੇ ਕਿ ਲੋਕ ਦੂਰੋਂ ਦੂਰੋਂ ਆ ਕੇ ਵੇਖਣ ਆਉਂਦੇ ਹਨ ਇੱਥੇ ਟਰਾਂਸਪੋਰਟ ਦਾ ਵੀ ਬਹੁਤ ਵਧੀਆ ਕੰਮ ਹੈ ਇੱਥੇ ਬਹੁਤ ਵੱਡੀਆਂ ਫੈਕਟਰੀਆਂ ਹਨ ਜੋ ਕਿ ਇੱਥੋਂ ਸਮਾਨ ਬਾਹਰ ਦੇਸ਼ਾਂ ਤੱਕ ਪਹੁੰਚਾਉਂਦੀਆਂ ਹਨ ਇੱਥੇ ਖੇਤੀਬਾੜੀ ਦਾ ਵੀ ਬਹੁਤ ਵਧੀਆ ਕੰਮ ਲੋਕ ਟੈਕਨੋਲਜੀ ਦੀਆਂ ਨਵੀਆਂ ਨਵੀਆਂ ਚੀਜ਼ਾਂ ਵਰਤ ਕੇ ਖੇਤੀਬਾੜੀ ਕਰਦੇ ਹਨ ਅਤੇ ਪਬਲਿਕ ਐਡਮਨਿਸਟਰੇਸ਼ਨ ਵੀ ਬਹੁਤ ਵਧੀਆ ਹੈ ਇੱਥੇ ਲੋਕ ਆਪਣਾ ਬਹੁਤ ਹੀ ਯੋਗਦਾਨ ਪਾਉਂਦੇ ਹਨ ਬਹੁਤ ਸਾਰੀਆਂ ਤਬਦੀਲੀਆਂ ਜੋ ਕਿ ਸਮਾਜਿਕ ਬੁਨ ਢਾਂਚੇ ਨੂੰ ਵੀ ਬਦਲਦੀਆਂ ਹਨ ਅਤੇ ਇੱਥੋਂ ਦੇ ਨਿਵਾਸੀਆਂ ਦੀ ਵੀ ਜ਼ਿੰਦਗੀ ਨੂੰ ਬਦਲਣ ਵਿੱਚ ਬਹੁਤ ਹੀ ਸਹਾਇਤਾ ਕਰਦੀਆਂ ਹਨ ਐਗਰੀਕਲਚਰ ਦੀ ਡਿਵੈਲਪਮੈਂਮੈਂਟ ਵਿੱਚ ਬਹੁਤ ਹੀ ਤਬਦੀਲੀ ਆਈ ਹੈ